ਮੇਰੇ ਵੱਲੋਂ ਆਖਰੀ ਐਪ ਡਾਊਨਲੋਡ ਜੋ ਕੀਤੀ ਗਈ ਹੈ ਉਸ ਦਾ ਨਾਮ ਇੰਸਟਾਗ੍ਰਾਮ ਟਵਿੱਟਰ ਸਨੈਪਚੈਟ ਅਤੇ ਫੇਸਬੁਕ ਹੈ ਇਹ ਐਪ ਲੋਕਾਂ ਦੇ ਵਿੱਚ ਪਸੰਦੀਦਾ ਐਪਾਂ ਦੇ ਵਿੱਚੋਂ ਇੱਕ ਹਨ ਇਹ ਦੋਸਤਾਂ ਅਤੇ ਪਰਿਵਾਰਾਂ ਨਾਲ ਸੰਪਰਕ ਵਿੱਚ ਰਹਿਣ ਲਈ ਕਾਫੀ ਵਧੀਆ ਵਰਤੀ ਜਾਂਦੀ ਹੈ ਨਵੇਂ ਸਮਾਗਮਾਂ ਅਤੇ ਖਬਰਾਂ ਦੀ ਜਾਣਕਾਰੀ ਵੀ ਇਸ ਤੋਂ ਪ੍ਰਾਪਤ ਕੀਤੀ ਜਾਂਦੀ ਹੈ ਇਹ ਐਪਾਂ ਵਟਸਐਪ ਟੈਲੀਗਰਾਮ ਸਿਗਨਲ ਇੰਮੋ ਆਦਿ ਇਹਨਾਂ ਐਪਾਂ ਦੇ ਨਾਲ ਲੋਕ ਗੱਲਬਾਤ ਕਰਨਾ ਸਮੂਹ ਚੈਟਾਂ ਵਿੱਚ ਹਿੱਸਾ ਲੈਣ ਅਤੇ ਮੀਡੀਆ ਸਾਂਝਾ ਕਰਨ ਲਈ ਵਰਤਦੇ ਹਨ ਇਹ ਐਪਾਂ ਜਿਵੇਂ ਕਿ ਜੀਮੇਲ ਆਊਟਲੁੱਕ ਯਾਹੂ ਮੇਲ ਇਹ ਐਪ ਲੋਕਾਂ ਨੂੰ ਆਪਣੇ ਇਨਬੋਕਸ ਦਾ ਪ੍ਰਬੰਧ ਕਰਨ ਅਤੇ ਇਮੇਲ ਸੰਚਾਰ ਕਰਨ ਵਿੱਚ ਮਦਦ ਕਰਦੀਆਂ ਹਨ ਇਹਨਾਂ ਦੇ ਵਿੱਚੋਂ ਕੁਛ ਐਪਾਂ ਜਿਵੇਂ ਕਿ ਗੂਗਲ ਡਰਾਈਵ ਡਰੋਪ ਬਾਕਸ ਟਰੈਲੋ ਅਤੇ ਆਸਾਨਾ ਇਹ ਲੋਕਾਂ ਵਿੱਚ ਪ੍ਰੋਜੈਕਟਾਂ ਦਾ ਪ੍ਰਬੰਧ ਕਰਨ ਦਸਤਾਵੇਜ਼ ਨੂੰ ਸਾਂਝੇ ਕਰਨ ਅਤੇ ਕਾਰਜਾਂ ਨੂੰ ਟਰੈਕ ਕਰਨ ਲਈ ਵਰਤਦੇ ਹਨ ਕੁਛ ਐਪਾਂ ਤਾਂ ਬੈਂਕਿੰਗ ਅਤੇ ਫਾਈਨੈਂਸ ਐਪਾਂ ਦੇ ਵੀ ਤੋਰ 'ਤੇ ਵੀ ਵਰਤੀਆਂ ਜਾਂਦੀਆਂ ਹਨ ਜਿਵੇਂ ਕਿ ਗੂਗਲ ਪੇਅ ਫੋਨਪੇਅ ਪੇਟੀਐਮ ਮੋਵੀਕਵਿਕ ਐਮਾਜ਼ੋਨ ਪੇਅ ਇਸ ਤਰੀਕੇ ਦੀ ਐਪਾਂ ਦੇ ਨਾਲ ਅਸੀਂ ਪੈਸਿਆਂ ਦਾ ਅਦਾਨ ਪ੍ਰਦਾਨ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਕਰ ਸਕਦੇ ਹਾਂ ਮਨੋਰੰਜਨ ਐਪਾਂ ਵੀ ਕਾਫੀ ਹਨ ਜਿਵੇਂ ਕਿ ਨੈੱਟਫਲਿਕਸ ਯੂਟਿਊਬ ਇੰਸਟਾਗਰਾਮ ਇਹ ਐਪਾਂ ਲੋਕਾਂ ਦਾ ਚੰਗੀ ਤਰ੍ਹਾਂ ਮਨੋਰੰਜਨ ਕਰਦੀਆਂ ਹਨ ਇਹਨਾਂ ਦੇ ਉੱਤੇ ਅਸੀਂ ਫਿਲਮਾਂ ਗਾਣੇ ਵੀਡੀਓਜ਼ ਰੀਲਜ਼ ਆਦਿ ਦੇਖਣ ਨੂੰ ਮਿਲਦੇ ਹਨ ਬਾਕੀ ਹੋਰ ਤਾਂ ਹੋਰ ਇਹਨਾਂ ਐਪਾਂ 'ਤੇ ਅਸੀਂ ਤੰਦਰੁਸਤੀ ਐਪ ਵੀ ਡਾਊਨਲੋਡ ਕਰ ਸਕਦੇ ਹਾਂ ਜਿਵੇਂ ਕੀ ਮਾਈਫਿਟਨੈਸ ਐਪ ਗੂਗਲ ਫਿੱਟ ਸਟਰਾਂਵਾ ਇਹਨਾਂ ਐਪ ਲੋਕਾਂ ਆਪਣੇ ਸਿਹਤ ਅਤੇ ਫਿਟਨੈਸ ਦੀ ਮਾਊ ਮਾਨਟਰਿਂਗ ਵਿੱਚ ਮਦਦ ਕਰਦੀਆਂ ਹਨ ਹੋਰ ਵੀ ਕਾਫੀ ਸਾਰੀਆਂ ਐਪ ਹਨ ਜੋ ਲੋਕਾਂ ਦੀ ਆਮ ਜ਼ਿੰਦਗੀ ਦੇ ਵਿੱਚ ਵਰਤਨਯੋਗ ਹਨ ਜਿਵੇਂ ਕਿ ਸਰਚ ਇੰਜਨ ਦੇ ਵਿੱਚ ਗੂਗਲ ਸਫਾਰੀ ਕਰੋਮ ਮਜੋਲਾ ਇੰਟਰਨੈਟ ਜਿਹੀਆਂ ਸੇਵਾਵਾਂ ਵਰਤਣ ਦੇ ਵਿੱਚ ਕਾਫੀ ਲਾਭਦਾਇਕ ਹੁੰਦੀਆਂ ਹਨ ਇਸ ਤੋਂ ਇਲਾਵਾ ਅਸੀਂ ਗੇਮਾਂ ਇਹਨਾਂ ਐਪਾਂ ਦੇ ਥਰੂਅ ਖੇਡ ਸਕਦੇ ਹਾਂ ਜਿਵੇਂ ਕਿ ਲੁੱਡੋ ਪਬਜੀ ਚੈੱਸ ਇਸ ਤਰ੍ਹਾਂ ਦੀਆਂ ਐਪਾਂ ਦੇ ਵਿੱਚ ਅਸੀਂ ਗੇਮਾਂ ਵੀ ਖੇਡ ਸਕਦੇ ਹਾਂ ਧੰਨਵਾਦ